ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਆਪਣਾ ਵਿਹਲਾ ਸਮਾਂ ਆਪਣੇ ਆਪ ਨੂੰ ਬੀਜੀ ਰੱਖ ਕੇ ਬਤੀਤ ਕਰਦਾ ਜਿਸਦੇ ਵਿੱਚ ਇੱਕ ਤਾਂ ਮੇਰੀ ਵਰਕਸ਼ਾਪ ਆ ਕੋਈ ਕੰਮ ਕਾਰ ਆ ਗਿਆ ਉੱਥੇ ਕਰ ਲਈਦਾ ਰਿਪੇਅਰ ਦਾ ਕੰਮ ਕਰ ਲਈਦਾ ਉਪਰੰਤ ਖੇਤ ਚਲੇ ਜਾਈਦਾ ਡੰਗਰਾਂ ਪਸ਼ੂਆਂ ਵਾਸਤੇ ਕੱਖ ਕੁੱਖ ਲਿਆਈਦੇ ਨੇ ਅਤੇ ਆਲੂ ਲਾਇਆ ਹੋਇਆ ਉਹਨਾਂ ਨੂੰ ਪਾਣੀ ਪੂਣੀ ਦੇ ਲਈਦਾ ਕਣਕ ਝੋਨੇ 'ਤੇ ਸਪਰੇਅ ਵਗੈਰਾ ਕੋਈ ਹੋਣੀ ਹੁੰਦੀ ਉਹ ਕਰ ਲਈਦੀ ਆ ਗੇੜਾ ਮਾਰ ਆਈਦਾ ਹਰ ਇੱਕ ਕੋਨੇ 'ਤੇ ਗੇੜਾ ਮਾਰੀਦਾ ਵੀ ਕੋਈ ਬਿਮਾਰੀ ਤਾਂ ਨਹੀਂ ਲੱਗੀ ਕੋਈ ਪੱਤਾ ਸ ਲਪੇਟ ਸੁੰਡੀ ਵਗੈਰਾ ਤਾਂ ਨਹੀਂ ਲੱਗੀ ਉਹ ਧਿਆਨ ਰੱਖੀਦਾ ਅਤੇ ਉਸ ਉਪਰੰਤ ਜੇ ਫੇਰ ਵੀ ਵਿਹਲੇ ਹੋਈਦਾ ਤਾਂ ਆ ਕੇ ਸੱਥ 'ਚ ਬਹਿ ਜਾਈਦਾ ਤਾਸ਼ ਤੂਸ਼ ਕੁੱਟੀਦੀ ਆ ਚਾਰ ਜਾਣਕਾਰੀ ਦੀਆਂ ਗੱਲਾਂ ਸੁਣੀ ਦੀਆਂ ਨੇ ਚਾਰ ਕਿਸੇ ਨੂੰ ਆਪਣਾ ਕੋਲ ਜਿਹੜੀ ਹੁੰਦੀ ਮਾੜੀ ਮੋਟੀ ਜਾਣਕਾਰੀ ਉਹ ਦਈ ਦੀ ਆ ਬਾਕੀ ਸਾ ਸਭ ਤੋਂ ਪਹਿਲਾਂ ਇੱਕ ਰਹਿ ਗਿਆ ਸੋਰੀ ਸਭ ਤੋਂ ਪਹਿਲਾਂ ਮੈਂ ਜਾਂਦਾ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਮਹਾਰਾਜ ਨੂੰ ਨਤਪਸ ਨਤਮਸਤਕ ਕਰੀਦਾ ਪਹਿਲਾਂ ਉਹ ਵੀ ਵਿਹਲਾ ਹੀ ਸਮਾਂ ਹੁੰਦਾ ਆਪਣਾ ਅਤੇ ਉੱਥੋਂ ਫਤਿਹ ਤੋਂ ਬਾਅਦ ਫੇਰ ਅੱਜ ਜੋ ਤੁਹਾਨੂੰ ਦੱਸਿਆ ਉਹ ਸਾਰਾ ਕੰਮ ਕਰ ਕੁਰ ਲਈਦਾ ਬਾਕੀ ਇੱਧਰ ਉੱਧਰ ਆਪਾਂ ਜ਼ਿਆਦਾ ਬੈਠਦੇ ਨਹੀਂ ਕਿਉਕਿ ਐਨ ਐਡੂ ਐਡਲ ਮੈਨ ਕੁਆਰਲਜ਼ ਵਿਦ ਹਿਦ ਹਿਸ ਟੂਲਜ਼ ਕਿਉਂਕਿ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਇਸ ਲਈ ਮੈਂ ਆਪਣੇ ਆਪ ਨੂੰ ਵਿਹਲਾ ਨਹੀਂਓ ਰੱਖਦਾ